ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਹੈ ਜਿਹਨਾਂ ਵਿੱਚ ਸਰਦਾਰ ਊਧਮ ਸਿੰਘ ਦੀ ਜੀਵਨੀ ਦੇ ਉੱਪਰ ਲਿਖੀ ਹੋਈ ਕਿਤਾਬ ਮੈਂ ਕਈ ਵਾਰ ਪੜ੍ਹੀ ਹੈ ਜੋ ਕਿ ਰਕੇਸ਼ ਕੁਮਾਰ ਸੁਨਾਮੀ ਦੀ ਲਿਖੀ ਹੋਈ ਹੈ ਜਿਸ ਦਾ ਨਾਮ ਗਦਰੀ ਸ਼ਹੀਦ ਊਧਮ ਸਿੰਘ ਭਾਰਤ ਦੀ ਆਜ਼ਾਦੀ ਦਾ ਪਰਵਾਨਾ ਨਾਮ ਹੈ ਇਸ ਦੇ ਉੱਪਰ ਬਹੁਤ ਹੀ ਵਧੀਆ ਫਿਲਮ ਵੀ ਬਣਾਈ ਹੋਈ ਹੈ ਜੋ ਕਿ ਜਿਸ ਦਾ ਨਾਮ ਸ਼ਹੀਦ ਊਧਮ ਸਿੰਘ ਹੈ ਜੋ ਬਹੁਤ ਲੋਕਾਂ ਨੂੰ ਪਸੰਦ ਹੈ ਮੈਂ ਤਾਂ ਵਾਰ ਵਾਰ ਇਹ ਫਿਲਮ ਕਈ ਵਾਰ ਦੇਖੀ ਹੈ ਅਤੇ ਮੈਂ ਇਹ ਕਿਤਾਬ ਜਦੋਂ ਵੀ ਪੜ੍ਹਦਾ ਹਾਂ ਤਾਂ ਮੈਨੂੰ ਕੋਈ ਨਾ ਕੋਈ ਨਵੀਂ ਗੱਲ ਨਵੀਂ ਸੋਚ ਹੀ ਮਿਲਦੀ ਹੈ